ਹੈਲੋ ਹਾਂਜੀ ਨਮਸਤੇ ਜੀ ਮੈਂ ਨੈਨਸੀ ਬੋਲਦੀ ਹਾਂ ਮੈਨੂੰ ਤੁਹਾਡਾ ਨੰਬਰ ਨਾ ਮੇਰੀ ਸਹੇਲੀ ਨੇ ਦਿੱਤਾ ਸੀ ਜੀ ਕਿਆ ਤੁਸੀਂ ਅਮਨ ਟਰੈਵਲਰ ਔਫਿਸ ਤੋਂ ਬੋਲਦੇ ਹਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਮਨ ਮੈਨੂੰ ਛੁੱਟੀਆਂ ਹੋਈਆਂ ਏ ਕਿ ਮੈਂ ਕਿੱਥੇ ਘੁੰਮਣ ਜਾਵਾਂ ਇਹਦੇ ਵਿੱਚ ਕੀ ਕੀ ਇਨਕੀਊਡ ਹੋਵੇਗਾ ਹਾਂਜੀ ਅੱਛਾ ਜੀ ਚਲੋ ਠੀਕ ਹੈ ਮੈਂ ਸੋਚ ਅੱਛਾ ਜੀ ਚਲੋ ਠੀਕ ਹੈ ਮੈਂ ਸੋਚ ਕੇ ਦੱਸਦੀ ਹਾਂ ਜੀ ਤੁਹਾਨੂੰ ਮੈਂ ਦੁਬਈ ਜਾਵਾਂ ਜਾਂ ਥਾਈਲੈਂਡ ਹਾਂਜੀ ਮੇਰੀ ਫਰੈਂਡ ਨੇ ਵੀ ਤੁਹਾਡੇ ਕੋਲੋਂ ਵੀਜ਼ਾ ਲਵਾਇਆ ਸੀ ਹਾਂਜੀ ਅਤੇ ਉਹ ਤੁਹਾਡੀਆਂ ਤ ਤਰੀਫ ਵੀ ਬਹੁਤ ਕਰਦੀ ਸੀ ਹਾਂ ਜੀ ਮੇਰੇ ਕੋਲ ਤੁਹਾਡਾ ਵਟਸਐਪ ਨੰਬਰ ਆ ਗਿਆ ਜੀ ਤੁਸੀਂ ਮੈਨੂੰ ਪਲੈਨਸ ਦੀ ਲਿਸਟ ਸੈਂਡ ਕਰ ਦਿਓ ਹਾਂਜੀ ਜੇ ਮੇਰੇ ਕੋਲ ਟਾਈਮ ਲੱਗਿਆ ਨਾ ਤਾਂ ਮੈਂ ਤੁਹਾਡੇ ਕੋਲ ਔਫਿਸ 'ਚ ਵੀ ਆਉਂਗੀ ਠੀਕ ਹੈ ਜੀ